ਪੰਜਾਬ ਨੈਸ਼ਨਲ ਬੈਂਕ ਪੰਜਾਬ ਐਂਡ ਸਿੰਧ ਬੈਂਕ ਪੰਜਾਬ ਗ੍ਰਾਮੀਣ ਬੈਂਕ ਐਚ ਡੀ ਐਫ ਸੀ ਬੈਂਕ ਆਈ ਸੀ ਆਈ ਸੀ ਆਈ ਬੈਂਕ